ਹੈਲ ਹਾਂਜੀ ਕੌਣ ਹਾਂਜੀ ਅਸੀਂ ਫੱਪੜਿਆਂ ਤੋਂ ਬੋਲਦੇ ਹਾਂ ਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਸਕੂਲ ਬਹੁਤ ਵਧੀਆ ਸਕੂਲ ਤਾਂ ਜੀ ਬਹੁਤ ਵਧੀਆ ਮਤਲਬ ਹਾਂ ਅਤੇ ਹਰ ਇੱਕ ਤਰ੍ਹਾਂ ਦੀ ਸਹੂਲਤ ਹੈ ਸਕੂਲ 'ਚ ਮਤਲਬ ਵੀ ਬਹੁਤ ਵਧੀਆ ਸਟਾਫ਼ ਹੈ ਬੱਚਿਆਂ ਦੀ ਪੂਰੀ ਕੇਅਰ ਕਰਦੇ ਨੇ ਪੂਰਾ ਵਧੀਆ ਪੜ੍ਹਾਉਂਦੇ ਨੇ ਕੋਈ ਇੱਦਾਂ ਦੀ ਗੱਲ ਨਹੀਂ ਹਰ ਇੱਕ ਚੀਜ਼ ਦਾ ਪ੍ਰਬੰਧ ਹੈ ਪਾਣੀ ਦਾ ਪ੍ਰਬੰਧ ਵੈਨਾਂ ਦਾ ਪ੍ਰਬੰਧ ਬਾਕੀ ਵਧੀਆ ਸਟੱਡੀ ਕਰਵਾਉਂਦੇ ਨੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਆਪਾਂ ਨੂੰ ਕੋਈ ਬੱਚਿਆਂ ਪ੍ਰਤੀ ਕੋਈ ਦਿੱਕਤ ਆਊਗੀ ਵੀ ਬੱਚਿਆਂ ਦੀ ਪੜ੍ਹਾਈ ਨਹੀਂ ਸਹੀ ਹੋ ਰਹੀ ਬਹੁਤ ਵਧੀਆ ਪੜ੍ਹਾਈ ਕਰਵਾਉਂਦੇ ਨੇ ਅਤੇ ਅਸੀਂ ਪਿਛਲੇ ਸਾਲ ਹੀ ਲਾਇਆ ਸੀ ਆਪਣਾ ਬੇਟਾ ਹਾਂਜੀ ਅਤੇ ਮਤਲਬ ਵੀ ਬਹੁਤ ਵਧੀਆ ਸਕੂਲ ਆ ਹੁਣ ਅੱਗੇ ਵੀ ਉੱਥੇ ਹੀ ਉਹਦੀ ਐਡਮਿਸ਼ਨ ਕਰਵਾਈ ਹੈ ਹਾਂਜੀ ਅਤੇ ਬਾਕੀ ਦੂਜੇ ਬੱਚੇ ਵੀ ਆਪਣੇ ਉੱਥੇ ਹੀ ਲਾਉਣ ਦੀ ਸਲਾਹ ਹੈ ਸਾਡੀ ਛੁੱਟੀਆਂ ਤੋਂ ਬਾਅਦ ਬੱਚਿਆਂ ਨੂੰ ਦੂਜਿਆਂ ਨੂੰ ਵੀ ਹਾਂ ਦੂਜਿਆਂ ਨੂੰ ਵੀ ਉੱਥੇ ਹੀ ਲਾਵਾਂਗੇ ਅਸੀਂ ਅਤੇ ਤੁਸੀਂ ਕੋਈ ਗੱਲ ਨਹੀਂ ਤੁਸੀਂ ਆ ਜਾਇਓ ਜੇ ਤੁਹਾਨੂੰ ਐਵੇਂ ਲੱਗਦਾ ਆਪਾਂ ਜਾ ਆਵਾਂਗੇ ਪੁੱਛ ਆਵਾਂਗੇ ਤੁਸੀਂ ਦੇਖ ਆਇਓ ਇੱਕ ਵਾਰ ਚੈੱਕ ਕਰ ਆਇਓ ਹਾਂਜੀ ਹਾਂ ਹਾਂ ਹਾਂ ਹਾਂ ਪੂਰੀਆਂ ਵਧੀਆ ਸਹੂਲਤਾਂ ਨੇ ਬਿਲਡਿੰਗਾਂ ਪੂਰੀਆਂ ਵਧੀਆ ਨੇ ਅ ਟੀਚਰ ਪੂਰੇ ਵਧੀਆ ਨੇ ਮਤਲਬ ਬੱਚਿਆਂ ਦੀ ਕੇਅਰ ਪੂਰੀ ਵਧੀਆ ਕਰਦੇ ਨੇ ਇੱਥੋਂ ਤੱਕ ਕਿ ਮਤਲਬ ਹੋਸਟਲ ਦਾ ਵੀ ਪ੍ਰਬੰਧ ਹੈ ਪਾਣੀ ਦਾ ਸਾਫ਼ ਸੁਥਰਾ ਪਾਣੀ ਹੈ ਏ ਸੀ ਨੇ ਮਤਲਬ ਪੂਰਾ ਵਧੀਆ ਸਕੂਲ ਹੈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਆਪਾਂ ਨੂੰ ਕੋਈ ਸਕੂਲ ਪ੍ਰਤੀ ਕੋਈ ਕੰਪਲੇਂਟ ਆਊਗੀ ਮਤਲਬ ਬਹੁਤ ਵਧੀਆ ਸਕੂਲ ਹੈ ਅਤੇ ਤੁਸੀਂ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਆਪ ਵੀ ਨਾਲ ਚਲ ਵੜਿਓ ਅਤੇ ਚੈੱਕ ਕਰ ਲਿਓ ਦੇਖ ਆਇਓ ਹਾਂ ਹਾਂ ਫੀਸ ਵਗੈਰਾ ਤਾਂ ਹੁਣ ਵੀ ਜਿਵੇਂ ਮਤਲਬ ਫੀਸ ਤਾਂ ਹੈਗੀ ਹੈ ਮਤਲਬ ਵੀ ਜਿਵੇਂ ਵੈਨ ਦੀ ਫੀਸ ਹੋ ਗਈ ਬਾਕੀ ਆਪਣੇ ਬੱਚਿਆਂ ਨੂੰ ਕਿਤਾਬਾਂ ਵੀ ਮਤਲਬ ਆਪ ਦਿੰਦੇ ਨੇ ਉਹ ਅਤੇ ਮਤਲਬ ਹਾਂ ਅਤੇ ਮਤਲਬ ਵੀ ਡਰੈੱਸ ਡਰੈੱਸ ਆਪਾਂ ਨੂੰ ਬਾਹਰੋਂ ਲੈਣੀ ਪੈਂਦੀ ਹੈ ਅਤੇ ਫੀਸ ਬ ਹਾਂ ਹਾਂ ਵੀ ਫੀਸ ਹੈਗੀ ਆ ਵਾਹ ਵਾਹ ਬਾਕੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਆ ਜਿਓ ਆਪਾਂ ਜਾ ਕੇ ਮਤਲਬ ਟੀਚਰਾਂ ਨਾਲ ਗੱਲ ਕਰ ਆਵਾਂਗੇ ਹਾਂ ਹਾਂ ਟੀਚਰ ਬਹੁਤ ਵਧੀਆ ਨੇ ਟੀਚਰਾਂ ਦੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਟੀਚਰ ਬਹੁਤ ਵਧੀਆ ਨੇ ਮਤਲਬ ਬੱਚਿਆਂ ਨੂੰ ਇੰਨੇ ਪਿਆਰ ਨਾਲ ਹੈਂਡਲ ਕਰਦੀਆਂ ਨੇ ਮਤਲਬ ਵੀ ਵਧੀਆ ਸਾਰਾ ਸਮਝਾਉਂਦੀਆਂ ਨੇ ਜੇ ਕਈ ਵਾਰ ਬੱਚੇ ਨੂੰ ਕੁਛ ਨਹੀਂ ਸਮਝ ਆਉਂਦਾ ਬੱਚੇ ਨੂੰ ਦੁਬਾਰਾ ਦੁਬਾਰਾ ਪੁੱਛਦੇ ਨੇ ਵੀ ਤੁਸੀਂ ਮਤਲਬ ਵੀ ਤੁਹਾਨੂੰ ਕੀ ਨਹੀਂ ਸਮਝ ਆਇਆ ਹੈਗਾ ਤੁਸੀਂ ਦੱਸੋ ਮਤਲਬ ਹਾਂ ਮਤਲਬ ਵੀ ਸਮਰ ਕੈਂਪ ਵੀ ਲਗਾਉਂਦੇ ਨੇ ਮਤਲਬ ਗੇਮ ਵੀ ਕਰਵਾਉਂਦੇ ਨੇ ਅਤੇ ਬਹੁਤ ਵਧੀਆ ਸਕੂਲ ਹੈ ਵੀ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਆਪਾਂ ਨੂੰ ਕੋਈ ਐਂ ਲੱਗੂਗਾ ਵੀ ਸਕੂਲ ਵੀ ਵਧੀਆ ਨਹੀਂ ਹੈਗਾ ਅਤੇ ਅਸੀਂ ਆਈ ਸੀ ਆਈ ਬੋਰਡ ਹੈ ਮਤਲਬ ਵੀ ਉੱਚੇ ਲੈਵਲ ਦਾ ਸਕੂਲ ਹੈ ਹਾਂਜੀ ਹਾਂਜੀ ਓ ਓਕੇ ਓਕੇ ਓਕੇ